ਹਾਂਜੀ ਭੰਗੜਾ ਸਾਡੇ ਲਈ ਬਹੁਤ ਮਹੱਤਵਪੂਰਨ ਵਿੱਚ ਰੱਖਦੇ ਹਾਂ ਇਸ ਭੰਗੜੇ ਨਾਲ ਸਾਨੂੰ ਬਹੁਤ ਮਜ਼ਾ ਵੀ ਆਉਂਦਾ ਹੈ ਭੰਗੜਾ ਇੱਕ ਏਹੋ ਜਿਹੀ ਚ ਮਜ਼ੇਦਾਰ ਚੀਜ਼ ਹੈ ਕਿਉਂਕਿ ਜਦੋਂ ਅਸੀਂ ਭੰਗੜਾ ਭੰਗੜਾ ਪਾਉਂਦੇ ਹਾਂ ਤਾਂ ਸਾਨੂੰ ਬਹੁਤ ਵਧੀਆ ਵੀ ਲੱਗਦਾ ਹੈ ਔਰ ਆਪਣੇ ਪੂਰੇ ਸਰੀਰ ਦੀ ਐਕਸਰਸਾਈਜ਼ ਵੀ ਹੁੰਦੀ ਰਹਿੰਦੀ ਹੈ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਸੁਬਹਾ ਜਿਹੜੀ ਵਾਕਿੰਗ ਜਿਹੜੀ ਕਰਨੀ ਹੁੰਦੀ ਹੈ ਉਹ ਅਸੀਂ ਕਈ ਵਾਰ ਭੰਗੜਾ ਪਾ ਕੇ ਹੀ ਕਰ ਲੈਂਦੇ ਹਾਂ ਉਹਦੇ ਨਾਲ ਵੀ ਸਾਨੂੰ ਬੜਾ ਰਿਲੈਕਸ ਫੀਲ ਹੁੰਦਾ ਹੈ ਕਿਉਂਕਿ ਭੰਗੜਾ ਇੱਕ ਐਸੀ ਚੀਜ਼ ਆ ਉਹਨੂੰ ਜਿਸ ਤਰ੍ਹਾਂ ਵੀ ਲਗਾ ਲਵੋਂਗੇ ਤੁਸੀਂ ਉਹ ਹੀ ਚੀਜ਼ ਨਾਲ ਆਪਾਂ ਨੂੰ ਹਰ ਪਾਸੇ ਵਧੀਆ ਹੀ ਲੱਗਦਾ ਹੈ ਕਿਉਂਕਿ ਭੰਗੜਾ ਸਭ ਤੋਂ ਪੰਜਾਬ ਵਿੱਚ ਭੰਗੜਾ ਸਭ ਤੋਂ ਜਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ ਇਸ ਨੂੰ ਅਸੀਂ ਹਰ ਵਿਆਹ ਸ਼ਾਦੀਆਂ 'ਤੇ ਵੀ ਪਾ ਜਾਂਦੇ ਹਾਂ ਜਿਸ ਜਿਵੇਂ ਕਿ ਜਾਗੋ ਹੋ ਗਈ ਕੋਈ ਫੰਕਸ਼ਨ ਹੋ ਗਿਆ ਸਕੂਲਾਂ ਵਿੱਚ ਬੱਚਿਆਂ ਤੋਂ ਵੀ ਭੰਗੜਾ ਕਰਵਾਇਆ ਜਾਂਦਾ ਹੈ ਇਹਨੂੰ ਅ ਅਸੀਂ ਬਹੁਤ ਜ਼ਿਆਦਾ ਮੇਨ ਮੰਨਦੇ ਹਾਂ ਕਿਉਂਕਿ ਜੈਸੇ ਕੇ ਅਸੀਂ ਸਾਰੇ ਇਹਦੇ ਵਿੱਚ ਜੋਸ਼ੀਲੇ ਗਾਣੇ ਗਾਉਂਦੇ ਹਾਂ ਕਿਉਂਕਿ ਭੰਗੜੇ ਵਿੱਚ ਅਸੀਂ ਭੰਗੜੇ ਵਾਲੇ ਗਾਣੇ ਗਾਉਂਦੇ ਹਾਂ ਜਿਵੇਂ ਕਿ ਢੋਲ ਹੋਵੇ ਭੰਗੜਾ ਹੋਵੇ ਜੋਸ਼ੀਲੇ ਸੌਗ ਹੋ ਹੋਵੇ ਭੰਗੜਾ ਜੋਸ਼ੀਲੇ ਜੋਸ਼ੀਲੇ ਸੌਂਗ 'ਤੇ ਭੰਗੜਾ ਪਾਇਆ ਜਾਂਦਾ ਹੈ ਤਾਂ ਕਿ ਭੰਗੜੇ 'ਤੇ ਆਪਣਾ ਮੱਲੋ ਜੋਰੀ ਪੈਰ ਉੱਠ ਜਾਂਦਾ ਹੈ ਇਹਦੇ ਇਸ ਕਰਕੇ ਅਸੀਂ ਭੰਗੜੇ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ ਮੰਨਦੇ ਹਾਂ ਉਹਦੇ ਨਾਲ ਕਿ ਹਾਸੇ ਦਿਮਾਗ ਖੁਸ਼ੀ ਮਿਲਦੀ ਹੈ ਕਿਉਂਕਿ ਫਿਰ ਆਪਾਂ ਨੂੰ ਭੰਗੜਾ ਹਮੇਸ਼ਾ ਸਾਨੂੰ ਹੱਸਦਾ ਹੱਸਦਾ ਵੱਸਦਾ ਰੱਖਦਾ ਹੈ ਕਿਉਂਕਿ ਸਾਡੀ ਸਿਹਤ ਔਰ ਦਿਮਾਗ 'ਤੇ ਵੀ ਚੰਗਾ ਪ੍ਰਭਾਵ ਪੈਂਦਾ ਹੈ ਕਿਉਂਕਿ ਭੰਗੜਾ ਹਮੇਸ਼ਾਂ ਚੰਗੀ ਸਿਹਤ ਵਾਸਤੇ ਬਹੁਤ ਵਧੀਆ ਹੱਸਮੁਖਤਾ ਰਹਿਣ ਵਾਸਤੇ ਹੀ ਬਣਾਇਆ ਗਿਆ ਹੈ ਇਹ ਜਦੋਂ ਵੀ ਅਸੀਂ ਭੰਗੜਾ ਪਾਉਂਦੇ ਆ ਸਾਨੂੰ ਬਹੁਤ ਸ਼ਕਤੀ ਐਨਰਜੀ ਪੈਦਾ ਹੁੰਦੀ ਹੈ ਓਕੇ